ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਸੇਵਾ ਹੋਰ ਦੱਸੋ ਹਾਂਜੀ ਹਾਂਜੀ ਹਾਂਜੀ ਕਿੱਧਰ ਲਗਾਉਣਾ ਤੁਸੀਂ ਕਿੱਥੇ ਜੇ ਹਾਂਜੀ ਹਾਂਜੀ

ਹਾਂਜੀ ਹਾਂਜੀ ਗੱਲ ਇੱਦਾਂ ਵਾ ਜੀ ਅੱਜ ਹੁਣ ਨਾ ਸਾਰਾ ਕੁਛ ਤੁਸੀਂ ਜੋ ਵੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਸੇਵਾ ਸਾਰੀ ਕਿੱਥੇ ਕੁ ਲਗਾਉਣੀ ਚਾਹੋਗੇ ਅੱਜ ਕੱਲ੍ਹ ਤੁਸੀਂ ਆਪਾਂ ਸਾਰਾ ਬਾਹਰ ਲਗਾਇਆ ਵਾ ਆਪਣੀ ਸੇਵਾ ਤੁਸੀਂ ਬਾਹਰ ਲਗਾ ਸਕਦੇ ਹੋ ਜਿੱਥੇ ਤੁਸੀਂ ਲੰਗਰ ਲਗਾਉਣਾ ਅੰਦਰ ਜੇ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਜੇ ਤੁਸੀਂ ਸੇਵਾ ਪਾਉਣੀ ਚਾਹੁੰਦੇ ਹੋ ਉਹ ਤਾਂ ਤੁਹਾਨੂੰ ਪਤਾ ਹੋਵੇ ਵੀ ਗੋਲਕ ਲੱਗੀ ਹੁੰਦੀ ਹੈ ਜੇ ਤੁਸੀਂ ਸੇਵਾ ਕੁਛ ਵਰਤਾਉਣਾ ਚਾਹੁੰਦੇ ਹੋ ਲੰਗਰ ਹਾਲ ਵਿੱਚ ਸਾਰਾ ਕੁਛ ਤੁਸੀਂ ਦੇ ਸਕਦੇ ਹੋ ਤੁਸੀਂ ਆਪ ਲਗਾਉਣਾ ਚਾਹੁੰਦੇ ਹੋ ਤਾਂ ਫਿਰ ਬਾਹਰ ਗੁਰਦੁਆਰਾ ਸਾਹਿਬ ਤੋਂ ਬਾਅਦ ਤੁਸੀਂ ਲਗਾ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪਹਿਲਾਂ ਸਾਰਾ ਕੁਛ ਗੁਰਦੁਆਰੇ ਦੇ ਅੰਦਰ ਹੁੰਦਾ ਸੀ ਅਤੇ ਫਿਰ ਸੰਗਤਾਂ ਨੂੰ ਮੱਦੇ ਨਜ਼ਰ ਧਿਆਨ ਵਿੱਚ ਰੱਖਦਿਆਂ ਅਤੇ ਸਾਰਾ ਕੁਛ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੇ ਬਾਹਰ ਕੀਤਾ ਜਾਂਦਾ ਅਤੇ ਜੇ ਤੁਸੀਂ ਸੇਵਾ ਕਰਨੀ ਹੈ ਲਗਾਣੇ ਜੇ ਦੇਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਸੇਵਾ ਅੰਦਰ ਆਪਾਂ ਦੇਣੀ ਆ ਅਤੇ ਤੁਸੀਂ ਗੁ ਲੰਗਰ ਹਾਲ ਵਿੱਚ ਸਾਰਾ ਕੁਛ ਆਪਣੀ ਸੁੱਕੀ ਰਸਤ ਦੇ ਸਕਦੇ ਹੋ ਜੇ ਕੁਛ ਦੇਣਾ ਹੈ ਜਿੱਦਾਂ ਤੁਹਾਡਾ ਉੱਦਾਂ ਮਨ ਕਰਦਾ ਹੋਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ